ਵੈਸੇ ਤਾਂ ਅੱਜ ਕੱਲ੍ਹ ਹਰ ਕੋਈ ਸੋਸ਼ਲ ਮੀਡੀਆ ਉੱਤੇ ਹੈ ਹਰ ਕੋਈ ਬੰਦਾ ਸੋਸ਼ਲ ਮੀਡੀਆ 'ਤੇ ਯੂਜ ਕਰਦਾ ਹੈ ਕਾਫੀ ਸਾਰੇ ਲੋਕ ਇਹਦਾ ਗਲਤ ਫਾਇਦਾ ਵੀ ਚੁੱਕਦੇ ਨੇ ਅਤੇ ਕਾਫੀ ਸਾਰੇ ਇਹਦਾ ਸਹੀ ਫਾਇਦਾ ਵੀ ਚੁੱਕਦੇ ਨੇ ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ ਜੋ ਇਸ ਦਾ ਸਹੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਪਿਆ ਹੈ ਇਸ ਦੇ ਵਿੱਚ ਇੱਕ ਹੈ ਇਹ ਵੀ ਗੱਲ ਜ਼ਰੂਰੀ ਹੈ ਕਿ ਤੁਸੀਂ ਵੀ ਰੈਗੂਲਰ ਪੋਸਟ ਕਰਦੇ ਪਏ ਹੋ ਈ ਜਾਂ ਇੱਕ ਚੰਗਾ ਕੋਂਟੈਂਟ ਦੇ ਰਹੇ ਹੋ ਕਿ ਨਹੀਂ ਵੈਸੇ ਮੈਂ ਵੀ ਰੋਜ਼ ਦੀਆਂ ਰੈਗੂਲਰ ਪੋਸਟ ਕਰਦਾ ਹਾਂ ਬੇਸਿਕਲੀ ਗੱਲ ਕੀਤੀ ਜਾਵੇ ਇੰਸਟਾਗਰਾਮ ਉੱਤੇ ਸ਼ੋਰਟਸ ਜਾਂ ਰੀਲਸ ਬਣਾਉਣਾ ਅੱਜ ਕੱਲ੍ਹ ਦਾ ਟਰੈਂਡ ਹੀ ਬਣ ਚੁੱਕਿਆ ਹੈ ਅੱਜ ਕੱਲ੍ਹ ਹਰ ਕੋਈ ਇਸ ਦੇ ਉੱਤੇ ਸ਼ੋਰਟਸ ਜਾਂ ਰੀਲਸ ਬਣਾਉਂਦਾ ਹੀ ਬਣਾਉਂਦਾ ਹੈ ਭਾਵੇਂ ਇੰਸਟਾਗਰਾਮ ਹੋਵੇ ਭਾਵੇਂ ਯੂਟੀਊਬ ਹੋਵੇ ਹਰ ਕੋਈ ਕੰਟੈਂਟ ਦਿੰਦਾ ਹੈ ਹਰ ਕੋਈ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦਾ ਹੈ ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ ਜੋ ਪੋਸਟ ਕਰ ਰਿਹਾ ਹੈ ਇਸ ਲਈ ਜ਼ਰੂਰੀ ਨਹੀਂ ਕਿ ਪੋਸਟ ਕਰਨਾ ਕੋਈ ਮਾੜੀ ਗੱਲ ਹੀ ਹੁੰਦੀ ਹੈ ਤੁਸੀਂ ਆਪਣੀ ਲਾਈਫ ਨੂੰ ਇੱਕ ਫ ਤਸਵੀਰ ਦੇ ਵਿੱਚ ਕੈਦ ਕਰਕੇ ਚੰਗੀ ਤਰ੍ਹਾਂ ਇੱਕ ਪੋਸਟ ਬਣਾ ਕੇ ਉਹ ਨੂੰ ਇੱਕ ਸੋਸ਼ਲ ਮੀਡੀਆ ਉੱਤੇ ਪੋਸਟ ਕਰਦੇ ਹੋ ਉਹ ਇੱਕ ਚੰਗੀ ਗੱਲ ਹੈ ਕਾਫੀ ਸਾਰੇ ਲੋਕ ਤੁਹਾਡੀ ਪੋਸਟਾਂ ਨੂੰ ਵੇਖਦੇ ਵੀ ਨੇ ਇਹਦੇ ਨਾਲ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਦੂਸਰੀ ਜਗ੍ਹਾ 'ਤੇ ਬੰਦਾ ਜਾਂ ਕਿਹੜੇ ਕੋਨੇ ਦੇ ਵਿੱਚ ਕਿਹੜਾ ਬੰਦਾ ਕੀ ਕੰਮ ਕਰ ਰਿਹਾ ਹੈ ਅੱਜ ਉਹ ਕਿੱਥੇ ਗਿਆ ਅੱਜ ਉਹ ਕਿ ਕਰ ਰਿਹਾ ਸੀ ਅੱਜ ਉਹ ਕਿੱਧਰ ਨੂੰ ਕਿਹਨੂੰ ਮਿਲਣ ਗਿਆ ਸਭ ਕੁਛ ਤੁਹਾਨੂੰ ਇੱਕ ਪੋਸਟ ਤੋਂ ਵੀ ਪਤਾ ਚਲ ਚੱਲ ਸਕਦਾ ਹੈ ਜੇ ਕਾਫੀ ਸਾਰੀ ਸਟੋਰੀ ਵੀ ਚਾੜ ਦੇ ਨੇ ਕਿ ਬਾਈ ਕਿ ਅੱਜ ਮੈਂ ਇੱਥੇ ਗਿਆ ਸੀ ਜਾਂ ਮੈਂ ਉੱਥੇ ਗਿਆ ਸੀ ਇਹਦਾ ਕਾਫੀ ਸਾਰੇ ਲੋਕਾਂ ਨੂੰ ਇਹ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਕਾਫੀ ਸਾਰੇ ਲੋਕ ਕਰਦੇ ਕੀ ਪਏ ਨੇ ਇਸ ਲਈ ਕਾਫੀ ਜ਼ਰੂਰੀ